ਸਪੀਕ ਆਊਟ ਦਾ ਫੋਲਇੰਗ ਨੇਮਸ ਔਰ ਟਾਈਟਲਸ ਓਫ ਦਾ ਪੀਪਲ ਵੋਕ ਸ਼ੂ ਕ੍ਰਿਸਚਨ ਹਿੰਦੂਸ ਪਰਸਿਸ ਬੁੱਧਇਸਟ ਮੁਸਲਿਮ ਐਂਡ ਸ਼ਡਿਊਲ ਕਾਸਟ ਪੀਪਲ